ਤੁਸੀਂ ਬਰਤਨਾਂ ਵਾਲੀ ਦੁਕਾਨ ਤੋਂ ਬੋਲਦੇ ਹੋ ਅੱਛਾ ਅਸੀਂ ਨਾ ਬਰਤਨ ਲੈਣੇ ਸੀਗੇ ਵੱਡੇ ਵੱਡੇ ਬਰਤਨ ਅਤੇ ਵੀ ਜਿਵੇਂ ਕੜਾਹੀ ਕੀ ਕੁਝ ਹੈ ਤੁਹਾਡੇ ਕੋਲ ਵੱਡਾ ਹਾਂਜੀ ਹਾਂਜੀ ਸਾਰਾ ਕੁਝ ਹੀ ਲੈਣਾ ਅਸੀਂ ਹਾਂਜੀ ਅੱਛਾ ਅਤੇ ਕੜਾਹੀ ਅਤੇ ਕੜਾਹੀ ਵੀ ਜਿਵੇਂ ਵੱਡੀ ਲੈਣੀ ਅਸੀਂ ਖੋਏ ਵਾਲੀ ਅੱਛਾ ਅੱਛਾ ਅੱਛਾ ਅਤੇ ਬਾਲਟੀ ਧਾਰ ਚੋਣ ਵਾਸਤੇ ਵੀ ਦੁੱਧ ਚੋਣ ਵਾਸਤੇ ਮੱਝ ਦਾ ਵੱਡੀ ਹੋਵੇ ਇੱਕ ਤਾਂ ਖੁੱਲ੍ਹੀ ਹੋਣੀ ਚਾਹੀਦੀ ਹੈ ਅੱਛਾ ਥੱਲੇ ਕੜਾਹ ਬਣਿਆ ਹੁੰਦਾ ਕਿ ਵੈਸੇ ਹੀ ਹੁੰਦਾ ਅੱਛਾ ਅਤੇ ਜਿਹੜੀ ਕੜਾਹੀ ਹੈ ਉਹ ਵੀ ਲੋਹੇ ਦਾ ਕੋਈ ਹੁੰਦਾ ਹਿਸਾਬ ਬਈ ਕੇ ਕਿਹੜਾ ਲੋਹਾ ਹੁੰਦਾ ਵਜਦਾ ਇਹ ਅੱਛਾ ਅੱਛਾ ਅੱਛਾ ਅੱਛਾ ਲੋਹੇ ਦਾ ਕੋਈ ਫਰਕ ਨਹੀਂ ਹੁੰਦਾ ਇੱਕੋ ਜਿਹਾ ਹੀ ਹੁੰਦਾ ਅੱਛਾ ਅੱਛਾ ਸਾਗ ਵਾਲਾ ਜਿਵੇਂ ਸਾਗ ਬਣਾਉਣ ਵਾਸਤੇ ਖੁੱਲ੍ਹਾ ਬਈ ਜਿਵੇਂ ਵੀ ਪੰਦਰਾਂ ਜਣਿਆਂ ਦਾ ਸਾਗ ਬਣ ਜੇ ਵਿੱਚ ਅੱਛਾ ਜਾ ਜੀ ਲੋਹੇ ਦਾ ਹੁੰਦਾ ਢੱਕਣ ਵਾਲਾ ਅੱਛਾ ਅੱਛਾ ਅਤੇ ਹੋਰ ਕੋਈ ਵੱਡੀ ਚੀਜ਼ ਜਿਵੇਂ ਆ ਨਹੀਂ ਹੁੰਦੀਆਂ ਗਈਆਂ ਬਲਟੋਹੀਆਂ ਪੰਜੀਰੀ ਪਾਉਣ ਵਾਸਤੇ ਪਿੱਤਲ ਦੀਆਂ ਅੱਛਾ ਅੱਛਾ ਚਲੋ ਸਾਰਾ ਕੁਝ ਹੀ ਮਿਲ ਜਾਂਦਾ ਵੱਡੇ ਵੱਡੇ ਭਾਂਡੇ ਆ ਚਲੋ ਠੀਕ ਹੈ ਅੱਛਾ ਅੱਛਾ ਚਲ ਫਿਰ ਅਸੀਂ ਆਉਂਦੇ ਆ ਫਿਰ ਵੇਖਦੇ ਹਾਂ ਠੀਕ ਆ